ਬਰਤਨ ਧੋਣ ਦਾ ਸਭ ਤੋਂ ਅੱਛਾ ਜੋ ਤਰੀਕਾ ਹੈ ਸਭ ਤੋਂ ਪਹਿਲਾਂ ਬਰਤਨਾਂ 'ਚ ਲੱਗੀ ਹੋਈ ਜੂਠ ਜੋ ਹੁੰਦੀ ਹੈ ਉਹਨਾਂ ਨੂੰ ਸਿੰਪਲ ਪਾਣੀ ਨਾਲ ਧੋਣਾ ਚਾਹੀਦਾ ਉਸ ਤੋਂ ਬਾਅਦ ਸਾਬਣ ਦੇ ਨਾਲ ਉਹਨਾਂ ਨੂੰ ਚੰਗੀ ਤਰ੍ਹਾਂ ਮਾਂਜਣ ਮਾਂਜ ਕੇ ਅਤੇ ਧੋਣਾ ਚਾਹੀਦਾ ਔਰ ਅਗਰ ਗੱਲ ਕਰੀਏ ਆਪਾਂ ਤੇਲ ਵਾਲੇ ਬਰਤਨਾਂ ਦੀ ਚਿਕਨਾਈ ਵਾਲੇ ਬਰਤਨ ਧੋਣ ਲਈ ਮਤਲਬ ਦੇਸੀ ਜੋ ਤਰੀਕਾ ਹੈ ਉਹ ਗਰਮ ਪਾਣੀ ਨਾਲ ਧੋਣੇ ਚਾਹੀਦੇ ਨੇ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਫਿਰ ਉਹ ਆਰਾਮ ਨਾਲ ਸਾਬਣ ਨਾਲ ਮਾਂਜੇ ਜਾਂਦੇ ਨੇ ਮਾਂਜਣ ਤੋਂ ਬਾਅਦ ਉਹਨਾਂ ਨੂੰ ਧੋ ਕੇ ਸੁਕਾ ਕੇ ਬਸ ਇਹੀ ਤਰੀਕਾ ਹੁੰਦਾ ਬਰਤਨ ਸਾਫ ਕਰਨ ਦਾ